ਸਤਿ ਸ਼੍ਰੀ ਅਕਾਲ ਜੀ ਮੇਰਾ ਪਸੰਦੀਦਾ ਅਭਿਨੇਤਾ ਐਮੀ ਵਿਰਕ ਹੈ ਐਮੀ ਵਿਰਕ ਦੀਆਂ ਬਹੁਤ ਸਾਰੀਆਂ ਫਿਲਮਾਂ ਮੈਨੂੰ ਪਸੰਦ ਆ ਉਹਨਾਂ ਵਿੱਚੋਂ ਆ ਜਾ ਮੈਕਸੀਕੋ ਚੱਲੀਏ ਨਿੱਕਾ ਜੈਲਦਾਰ ਅੰਨੀ ਦਿਆ ਮਜ਼ਾਕ ਐ ਠੀਕ ਹੈ ਇਸ ਤਰ੍ਹਾਂ ਉਹਦੀਆਂ ਬਹੁਤ ਸਾਰੀਆਂ ਫਿਲਮਾਂ ਮੈਨੂੰ ਜਿਹੜੀਆਂ ਵਾ ਉਹ ਪਸੰਦ ਆ ਨਿੱਕਾ ਜੈਲਦਾਰ ਵਿੱਚ ਉਹਨੇ ਬਹੁਤ ਵਧੀਆ ਕਿਰਦਾਰ ਕਿਰਦਾਰ ਜਿਹੜਾ ਨਿਭਾਇਆ ਉਹ ਬੜਾ ਸੀਰੀਅਸ ਕਰੈਕਟਰ ਵੀ ਅਤੇ ਬੜਾ ਫਨ ਵੀ ਸੀ ਉਹ ਫਿਲਮ ਦੇ ਵਿੱਚ ਬੰਦਾ ਟੈਨਸ਼ਨ ਵਿੱਚ ਹੋਊਗਾ ਅਤੇ ਟੈਂਸ਼ਨ ਤੋਂ ਰਿਲੀਵ ਕਰਨ ਵਾਲਾ ਟੈਨਸ਼ਨ ਘਟਾਉਣ ਵਾਲਾ ਜਿਹੜਾ ਉਹਦਾ ਸੀ ਉਹ ਕਿਰਦਾਰ ਸੀ ਇਸ ਤੋਂ ਇਲਾਵਾ ਆ ਜਾ ਮੈਕਸੀਕੋ ਚੱਲੀਏ ਵਿੱਚ ਉਹਦਾ ਬਹੁਤ ਹੀ ਜ਼ਿਆਦਾ ਜਿਹੜਾ ਸੀ ਉਹ ਸੀਰੀਅਸ ਕਿਰਦਾਰ ਜਿਹੜਾ ਸੀ ਉਹ ਹੈਗਾ ਸੀ ਉਹ ਫਿਲਮ ਨੇ ਲੋਕਾਂ ਨੂੰ ਬਹੁਤ ਸੇਧ ਵੀ ਦਿੱਤੀ ਅਤੇ ਉਹ ਫਿਲਮ ਨੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਇਮੋਸ਼ਨਲੀ ਟੱਚ ਜਿਹੜਾ ਹੈਗਾ ਸੀ ਜਿਹੜਾ ਇਨਸਾਨ ਨੂੰ ਸੋਚਣ ਲਈ ਜਿਹੜਾ ਵਾ ਮਜ਼ਬੂਰ ਕਰ ਦਿੰਦਾ ਠੀਕ ਹੈ ਅਤੇ ਮੇਰੀ ਫੇਵਲਰ ਫੇਵਰੇਟ ਜਿਹੜੀ ਆ ਜਾ ਪਸੰਦੀਦੀ ਅਭਿਨੇਤਾ ਅਭਿਨੇਤਰੀ ਜਿਹੜੀ ਆ ਉਹ ਹੈਗੀ ਆ ਨੀਰੂ ਬਾਜਵਾ ਨੀਰੂ ਬਾਜਵੇ ਦੀ ਪਿਚਰਸ ਜੱਟ ਐਂਡ ਜੂਲੀਅਟ ਲੌਂਗ ਅਤੇ ਲਾਚੀ ਔਰ ਇਸ ਤੋਂ ਇਲਾਵਾ ਇਹਦੀ ਬੂਹੇ ਬਾਰੀਆਂ ਪਿਚਰ ਇਹ ਬਹੁਤ ਸੋਹਣੀਆਂ ਫਿ ਪਿਚਰਸ ਆ ਇਹਦੀ ਦਿਲਜੀਤ ਨਾਲ ਜਿਹੜੀ ਜੱਟ ਐਂਡ ਜੂਲੀਅਟ ਪਿਚਰ ਆ ਉਹ ਇੱਕ ਬੜੀ ਹਾਸਰਸ ਭਰਪੂਰ ਫਿਲਮ ਆ ਜਿਹਨੂੰ ਵੇਖ ਕੇ ਇਨਸਾਨ ਨੂੰ ਜਿਹੜਾ ਵਾ ਬਹੁਤ ਹੀ ਜ਼ਿਆਦਾ ਮਜ਼ਾ ਵੀ ਆਉਂਦਾ ਅਤੇ ਉਹਦੇ ਵਿੱਚ ਨੀਰੂ ਬਾਜਵਾ ਦਾ ਜਿਹੜਾ ਵਾ ਰੋਲ ਆ ਉਹ ਬਹੁਤ ਹੀ ਜ਼ਿਆਦਾ ਵਾ ਵਧੀਆ ਤਰੀਕੇ ਨਾਲ ਜਿਹੜਾ ਵਾ ਉਹਨੇ ਆਪਣੇ ਰੋਲ ਨੂੰ ਜਿਹੜਾ ਵਾ ਉਹ ਨਿਭਾਇਆ ਵਾ ਅਤੇ ਇਸ ਲਈ ਮੈਨੂੰ ਉਹਦੀ ਉਹ ਫਿਲਮ ਬਹੁਤ ਪਸੰਦ ਹੈ ਇਸ ਤੋਂ ਇਲਾਵਾ ਲੌਂਗ ਅਤੇ ਲਾਚੀ ਲੌਂਗ ਅਤੇ ਲਾਚੀ ਵਿੱਚ ਵੀ ਜਿਹੜੀ ਜ਼ਿੰਦਗੀ ਦੀਆਂ ਅਸਲੀਅਤ ਜਿਹੜੀ ਦੱਸੀ ਗਈ ਉਹਦੇ ਵਿੱਚ ਉਹਨੇ ਇੱਕ ਪੇਂਡੂ ਔਰਤ ਦਾ ਕਿਰਦਾਰ ਵੀ ਨਿਭਾਇਆ ਇਸ ਤੋਂ ਇਲਾਵਾ ਉਹਨੇ ਇੱਕ ਜਿਹੜੀ ਆ ਉਹ ਬਹੁਤ ਪੜ੍ਹੀ ਲਿਖੀ ਹੋਈ ਮਤਲਬ ਵਧੀਆ ਤਰੱਕੀ ਕੀਤੀ ਇੱਕ ਪੈਸਾ ਕਮਾਉਣ ਵਾਲੀ ਔਰਤ ਦਾ ਜਿਹੜਾ ਵਾ ਉਹ ਕਿਰਦਾਰ ਵੀ ਨਿਭਾਇਆ ਦੋਵੇਂ ਕਿਰਦਾਰ ਉਹਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਏ ਇਸ ਲਈ ਮੈਨੂੰ ਉਹ ਬਹੁਤ ਪਸੰਦ ਆ ਧੰਨਵਾਦ